ਹੈਲੋ ਸਰ ਸਰ ਤੁਸੀਂ ਟਰਾਂਸਪੋਰਟ ਏਜੰਸੀ ਤੋਂ ਗੱਲ ਕਰ ਰਹੇ ਹੋ ਸਰ ਮੈਂ ਅੰਜਲੀ ਬੋਲਦੀ ਹਾਂ ਪਟਿਆਲੇ ਤੋਂ ਅਤੇ ਮੈਂ ਸਰ ਜਿਹੜੀ ਤੁਹਾਡੀ ਏਜੰਸੀ ਤੋਂ ਇੱਕ ਬੁੱਕ ਕੀਤੀ ਸੀ ਮੈਂ ਆਪਣੇ ਕ ਕੰਮ 'ਤੇ ਜਾਣਾ ਸੀ ਹਾਂਜੀ ਸਰ ਤੇ ਸਰ ਆ ਜਿਹੜੀ ਇਹ ਕੈਬ ਹੈ ਤੁਸੀਂ ਭੇਜੀ ਆਂ ਮੈਨੂੰ ਇੱਕ ਤਾਂ ਸਰ ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਦੋਂ ਟਰੈਵਰ ਨਿਕਲ ਰਿਹਾ ਕਦੋਂ ਨਹੀਂ ਸਰ ਇੱਕ ਤਾਂ ਤੁਸੀਂ ਪੰਦਰਾਂ ਮਿੰਟ ਡਰਾਈਵਰ ਲੇਟ ਹੈ ਸਰ ਦੂਜੀ ਗੱਲ ਇਹ ਕਿ ਇਹਦੀਆਂ ਜਿਹੜੀਆਂ ਸੀਟਾਂ ਨੇ ਸਰ ਫਟੀਆਂ ਹੋਈਆਂ ਅਤੇ ਹੁਣ ਮੈਂ ਰਾਸਤੇ ਦੇ ਵਿੱਚ ਖੜੀ ਹਾਂ ਸਰ ਜਿੱਥੇ ਜਿਹੜੀ ਕਾਰ ਹੈ ਖ਼ਰਾਬ ਹੋ ਚੁੱਕੀ ਹੈ ਸਰ ਸਰ ਇਹਦਾ ਹੋਰਨ ਵੀ ਕੰਮ ਨਹੀਂ ਕਰਦਾ ਹੈਗਾ ਸਰ ਤੁਸੀਂ ਕੀ ਕਰਾ ਮੈਂ ਹੁਣ ਸਰ ਮੈਂ ਲੇਟ ਹੋ ਰਹੀ ਹਾਂ ਅਤੇ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਸਰ ਜਾਂ ਤਾਂ ਮੇਰਾ ਰਿਫੰਡ ਵਾਪਸ ਕਰੋ ਤੁਸੀਂ ਪੈਸੇ ਜਾਂ ਫਿਰ ਸਰ ਮੈਨੂੰ ਹੁਣੇ ਦੇ ਹੁਣੇ ਕੈਬ ਬੁੱਕ ਕਰਕੇ ਭੇਜੋ ਸਰ ਅੱਧੇ ਘੰਟੇ 'ਚ ਕਿਵੇਂ ਭੇਜਣਾ ਸਰ ਸਰ ਮੈਂ ਇੰਨੀ ਲੇਟ ਹੋ ਰਹੀ ਹਾਂ ਮੈਂ ਆਪਣੇ ਕੰਮ 'ਤੇ ਜਾਣਾ ਸਰ ਪਹਿਲਾਂ ਹੀ ਤੁਸੀਂ ਪੰਦਰਾਂ ਮਿੰਟ ਲੇਟ ਆਇਆ ਡਰਾਈਵਰ ਸਰ ਤੁਹਾਡਾ ਸਰ ਮੈਨੂੰ ਨਹੀਂ ਪਤਾ ਮੈਨੂੰ ਜਾਂ ਤਾਂ ਮੇਰਾ ਰਿਫੰਡ ਵਾਪਸ ਕਰ ਦਿਓ ਸਰ ਹੁਣੇ ਦੇ ਹੁਣੇ ਜਾਂ ਫਿਰ ਜਿਹੜਾ ਹੈਗਾ ਮੈਨੂੰ ਕੋਈ ਨਵੀਂ ਬੈਗ ਕੈਬ ਜਿਹੜੀ ਹੈਗੀ ਆ ਬੁੱਕ ਕਰਕੇ ਦਿਓ ਨਹੀਂ ਸਰ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਜਲਦੀ ਤੋਂ ਜਲਦੀ ਸਲਿਊਸ਼ਨ ਕੱਢੋ ਅਤੇ ਮੈਨੂੰ ਦੋ ਮਿੰਟ ਦੇ ਵਿੱਚ ਵਿੱਚ ਅੰਦਰ ਜਿਹੜਾ ਹੈ ਦੁਬਾਰਾ ਬੈਕ ਕੋਲ ਕਰੋ ਸਰ ਤੇ ਮੈਂ ਦੱਸੋ ਕਿ ਮੇਰਾ ਸਲਿਊਸ਼ਨ ਕੀ ਨਿਕਲਿਆ ਮੈਂ ਤਾਂ ਲੇਟ ਹੋ ਰਹੀ ਹਾਂ ਸਰ ਜਲਦੀ ਕਰੋ ਤੁਸੀਂ ਓਕੇ ਸਰ